ਮੈਂ ਇੱਕ ਔਨਲਾਈਨ ਸਾੜੀ ਔਡਰ ਕੀਤੀ ਜੋ ਕਿ ਮੈਨੂੰ ਬਹੁਤ ਹੀ ਪਸੰਦ ਆਈ ਉਸ ਦਾ ਕੱਪੜਾ ਵੀ ਬਹੁਤ ਵਧੀਆ ਸੀ ਅਤੇ ਉਸ ਦਾ ਦਾਮ ਵੀ ਬਹੁਤ ਵਧੀਆ ਨਿਕਲਿਆ ਜੋ ਕਿ ਬਾਜ਼ਾਰ ਦੇ ਤੌਰ 'ਤੇ ਔਨਲਾਈਨ ਔਡਰ ਕਰਨ 'ਤੇ ਮੈਨੂੰ ਬਹੁਤ ਹੀ ਸਸਤੀ ਮਿਲ ਗਈ ਉਸ ਦਾ ਰੰਗ ਵੀ ਕਾਲਾ ਸੀ ਉਸ ਦਾ ਬਲਾਊਜ਼ ਗੋਲਡਨ ਰੰਗ ਦਾ ਸੀ ਉਸ ਦਾ ਪੱਲਾ ਅਤੇ ਪੱਟੀ ਵੀ ਗੋਲਡਨ ਸੀ ਦੋਨੋਂ ਹੀ ਬਹੁਤ ਹੀ ਸੋਹਣੇ ਸੀ ਜਦੋਂ ਮੈਂ ਉਸ ਨੂੰ ਪਾ ਕੇ ਬਾਹਰ ਨਿਕਲੀ ਤਾਂ ਮੇਰੇ ਮੁਹੱਲੇ ਦੀਆਂ ਔਰਤਾਂ ਨੇ ਉਸ ਨੂੰ ਬਹੁਤ ਹੀ ਪਸੰਦ ਕੀਤਾ ਮੇਰੀ ਇੱਕ ਦੋਸਤ ਨੇ ਵੀ ਮੇਰੇ ਵੱਲ ਦੇਖ ਕੇ ਉਹ ਸਾੜੀ ਨੂੰ ਔਡਰ ਕੀਤਾ ਉਸ ਨੇ ਉਸ ਮੇਰੇ ਤੋਂ ਹੀ ਉਸ ਦਾ ਸਾਰਾ ਅਡਰੈਸ ਲੈ ਕੇ ਉਹ ਸਾੜੀ ਨੂੰ ਔਡਰ ਕੀਤਾ ਮੈਂ ਆਪਣੇ ਤਰੀਕੇ ਨਾਲ ਸਾੜੀ ਦੀ ਪਰਚਿਆ ਕੀਤੀ ਜੋ ਕਿ ਸਾੜੀ ਮੈਨੂੰ ਬਹੁਤ ਹੀ ਪਸੰਦ ਆਈ ਔਨਲਾਈਨ ਸ਼ੋਪਿੰਗ ਕਰਨ 'ਤੇ ਵੀ ਕੱਪੜੇ ਇੰਨੇ ਵਧੀਆ ਮਿਲਦੇ ਹਨ ਮੈਨੂੰ ਨਹੀਂ ਸੀ ਪਤਾ ਸਾੜੀ ਅ ਭਾਰਤੀ ਸੱਭਿਅਤਾ ਹੈ ਇਹ ਔਰਤਾਂ ਨੂੰ ਬਹੁਤ ਪਸੰਦ ਹੈ ਜੋ ਕਿ ਹਰ ਇੱਕ ਤਿਉਹਾਰ 'ਤੇ ਪਾਈ ਜਾਂਦੀ ਹੈ ਇਸ ਨੂੰ ਪਾਉਣ 'ਤੇ ਵੀ ਕਈ ਪ੍ਰਕਾਰ ਦੀ ਕਾਂਜੀਵਰਮ ਬਨਾਰਸੀ ਸਿਲਕ ਅਤੇ ਹੋਰ ਪ੍ਰਕਾਰ ਦੀਆਂ ਸਾੜੀਆਂ ਹਨ ਜੋ ਕਿ ਅਲੱਗ ਅਲੱਗ ਦੇਸ਼ ਵਿੱਚ ਪਾਈਆਂ ਜਾਂਦੀਆਂ ਹਨ ਭਾਰਤ ਵਿੱਚ ਸਾੜੀ ਪਹਿਨ ਕੇ ਉਸ ਦਾ ਪ੍ਰਚਾਰ ਕਰਨਾ ਬਹੁਤ ਹੀ ਵਧੀਆ ਅਤੇ ਸੰਸਕ੍ਰਿਤੀ ਨਾਲ ਜੁੜਨ ਵਾਲਾ ਹੁੰਦਾ ਹੈ